ਹੈਲੋ ਸਤਿ ਸ਼੍ਰੀ ਅਕਾਲ ਜੀ ਔਰ ਕੀ ਹਾਲ ਚਾਲ ਮੈਂ ਨਦੌਣ ਤੋਂ ਆਏ ਹਾਂ ਗਏ ਓਂ ਹੁਣ ਸ਼ਿਫਟ ਕੀਤਾ ਹੁਸ਼ਿਆਰਪੁਰ ਅਸੀਂ ਹਾਂਜੀ ਹਾਂਜੀ ਅਸੀਂ ਮੈਂ ਪੁੱਛਣਾ ਹਾਂ ਹੁਸ਼ਿਆਰਪੁਰ ਦੇ ਬਾਰੇ 'ਚ ਕਿ ਕਿੱਦਾਂ ਦਾ ਹੈ ਉਹ ਇਹ ਮੇਰੇ ਦੋ ਨਾਲ ਹੀ ਮੇਰੇ ਰਹਿੰਦੇ ਦੋਸਤ ਨਾ ਉਹਨਾਂ ਨੇ ਦਿੱਤਾ ਕਿ ਇਹਨਾਂ ਦੇ ਇਹਨਾਂ ਨਾਲ ਦੋਸਤ ਨਾਲ ਆ ਸਤੀਸ਼ ਹਾਂਜੀ ਹਾਂਜੀ ਉਹਨਾਂ ਨੰਬਰ ਵੀ ਹਾਂਜੀ ਉਹਨੇ ਨੰਬਰ ਦਿੱਤਾ ਕਿ ਉਹਨਾਂ ਨਾਲ ਗੱਲ ਕਰ ਲਈਓ ਉਹ ਅੱਛੇ ਹੈਗੇ ਹਾਂਜੀ ਜੀ ਅੱਛਾ ਅੱਛਾ ਜੀ ਹਾਂਜੀ ਹਾਂ ਸ਼ਿਮਲਾ ਪਹਾੜ ਲਿਆ ਅਸੀਂ ਸ਼ਿਮਲਾ ਪਹਾੜੀ ਹਾਂਜੀ ਹਾਂਜੀ ਠੀਕ ਰੈਂਟ 'ਤੇ ਮਿਲ ਗਿਆ ਹਾਂਜੀ ਹਾਂਜੀ ਹੋਰ ਠੀਕ ਮਿਲ ਗਿਆ ਰੈਂਟ ਬਸ ਹੋਰ ਕੁ

ਗਰਮੀ ਵਗੈਰਾ ਠੰਡ ਵਗੈਰਾ ਗਰਮੀ ਠੰਡ ਠੀਕ ਹੈ ਗਰਮ ਹਾਂਜੀ ਹਾਂਜੀ ਹਾਂਜੀ ਹਾਂਜੀ ਲੈਣਾ ਸੀਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹੈਲਮੈਟ ਤਾਂ ਲਗਾਉਣਾ ਜ਼ਰੂਰੀ ਆਪਣੀ ਸੇਫਟੀ ਵਾਸਤੇ ਹੁੰਦਾ ਤਾਂ ਦਿਖਾਵਾ ਥੋੜ੍ਹੀ ਆ ਕਿਸੇ ਦਾ ਹਾਂਜੀ ਜੀ

ਹਾਂਜੀ ਹਾਂਜੀ ਹਾਂ ਜਿਸ ਤਰ੍ਹਾਂ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਚੌਂਕ ਦੇ ਹਾਂਜੀ ਹਾਂਜੀ ਚੌਂਕ ਕੋਲ ਹੀ ਘਰ ਸਾਡਾ ਜੀ ਅੱਛਾ ਜੀ ਹਾਂ ਉਧਰ ਆ ਗਿਆ ਅੱਛਾ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਜੀ

ਹਾਂਜੀ ਹਾਂਜੀ ਉੱਥੇ ਬਹੁਤ ਜ਼ਿਆਦਾ ਟਰੈਫਿਕ ਆ ਜਾਨੀ ਆ ਹਾਂਜੀ ਹਾਂ ਉਹ ਤਾਂ ਹੈਗਾ ਹੀ

ਹਾਂਜੀ ਹਾਂਜੀ ਉੱਥੇ ਤਾਂ ਖੜੇ ਰਹਿੰਦੇ ਹਾਂ ਉਹ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਹਾਂ ਉਹ ਤਾਂ ਹਰ ਜਗ੍ਹਾ ਹੀ ਆ ਹਾਂ ਹਾਂ ਅੱਛਾ ਅੱਛਾ ਹਾਂ ਉਹ ਉਹ ਤਾਂ ਹੈਗਾ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਜੀ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਕੋਈ ਨਹੀਂ ਠੀਕ ਹੈ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਧੰਨਵਾਦ ਹਾਂ ਠੀਕ ਹੈ ਜੀ